ਹੈਲੋ ਮੈਮ ਤੁਹਾਡੇ ਮੈਂ ਹੈਲੋ ਮੈਮ ਤੁਹਾਡੇ ਕਲੱਬ ਦੇ ਵਿੱਚ ਕਿਹੜੀ ਕਿਹੜੀ ਐਕਟੀਵਿਟੀਜ਼ ਹੈ ਠੀਕ ਹੈ ਇਹ ਇਹ ਈਵਨਿੰਗ ਈਵਨਿੰਗ ਜਾਂ ਮੋਰਿਨਿੰਗ ਟਾਈਮ ਕੀ ਹੈ ਅਤੇ ਤੁਹਾਡੇ ਕੋਚ ਕਿੱਥੋਂ ਆਉਂਦੇ ਹੈ ਅ ਅਤੇ ਤੁਹਾਡੇ ਤ ਤਰਨ ਤਾਰਨ ਦੇ ਵਿੱਚ ਜਿਹੜੇ ਕੋਚਿਸ ਹੈਗੇ ਆ ਇਹ ਕਿੱਥੋਂ ਤੋਂ ਕਹਿੰਦੇ ਨੇ ਲੈਵਲ ਆ ਇਹਨਾਂ ਦਾ ਠੀਕ ਹੈ ਅਤੇ ਜੂਡੋ ਕਰਾਟੇ ਵੀ ਹੈ ਗੇਮਸ ਇਹਦਾ ਫਾਇਦਾ ਕੀ ਹੈ

ਠੀਕ ਹੈ ਓਕੇ ਜੀ ਓਕੇ ਮੈਮ